ਮੇਰੇ ਦੋਸਤ ਅਗਰ ਤੂੰ ਗਲਤੀ ਨਾਲ ਜੋ ਆਪਣੇ ਜੁੜਵਾ ਬੱਚਿਆਂ ਦਾ ਡੁਪਲੀਕੇਟ ਜਨਮ ਰਜਿਸਟਰੇਸ਼ਨ ਅਰਜ਼ੀਆਂ ਜਮਾਂ ਕਰ ਦਿੱਤੀਆਂ ਹਨ ਤਾਂ ਚਿੰਤਾ ਨਾ ਕਰ ਇਸ ਦਾ ਵੀ ਹੱਲ ਹੈ ਤੂੰ ਤੈਨੂੰ ਪਹਿਲਾਂ ਸੁਵਿਧਾ ਕੇਂਦਰ ਜਾਣਾ ਪਊਗਾ ਉੱਥੇ ਜਾ ਕੇ ਉਹਨਾਂ ਨੇ ਸ ਸਹਾਇਕ ਨਾਲ ਗੱਲ ਕਰਨੀ ਪਊਗੀ ਫਿਰ ਉਹਨੂੰ ਉਹਨਾਂ ਨੂੰ ਕਹਿਣਾ ਉਹਨਾਂ ਨੂੰ ਅਰਜ਼ੀ ਪਾਉਣੀ ਪਊਗੀ ਕਿ ਤੇਰੀ ਤੇਰੇ ਤੋਂ ਆਪਣੇ ਜੁੜਵਾਂ ਬੱਚਿਆਂ ਦੀ ਦੋ ਅਰਜ਼ੀਆਂ ਦੇ ਦਿੱਤੀਆਂ ਜਾ ਚੁੱਕੀਆਂ ਹਨ ਅਤੇ ਉਹਨਾਂ 'ਚੋਂ ਇੱਕ ਨੂੰ ਰੱਦ ਕਰ ਦਿੱਤਾ ਜਾਵੇ ਅਤੇ ਉਸ ਉਹ ਥੋੜ੍ਹੀ ਦੇਰ ਤੱਕ ਇਸ ਨੂੰ ਰੱਦ ਕਰ ਦੇਣਗੇ ਪਰ ਇਸ ਪਰ ਧਿਆਨ ਪਰ ਆਪਣਾ ਧਿਆਨ ਰੱਖੀਂ ਕਿ ਉਹ ਤੇਰੀ ਦੋਨੋਂ ਨਾ ਦੋਨੋਂ ਰਜਿਸਟਰੇਸ਼ਨ ਜਿਹੜੀਆਂ ਤੇਰੀਆਂ ਅਰਜ਼ੀਆਂ ਹਨ ਉਹਨੂੰ ਨਾ ਰੱਦ ਕਰ ਦੇਣ ਇਸ ਕਰਕੇ ਆਪਣੇ ਸਾਹਮਣੇ ਹੀ ਕਰਵਾ ਲਈ ਅਤੇ ਇਸ ਚੀਜ਼ ਤੋਂ ਇਸ ਇਸ ਦੁਰਘਟਨਾ ਤੋਂ ਬਚਣ ਵਾਸਤੇ ਭਵਿਸ਼ਕ ਭਵਿੱਖ ਵਿੱਚ ਸਾਵਧਾਨੀ ਨਾਲ ਵਰਤੀ ਅਤੇ